ਸਤਿ ਸ਼੍ਰੀ ਅਕਾਲ ਸਰ ਤੁਸੀਂ ਵੰਨ ਪੁਆਇੰਟ ਤੋਂ ਬੋਲਦੇ ਹਾਂ ਮੈਂ ਪਿਛਲੇ ਹੀ ਮਹੀਨੇ ਤੁਹਾਡੇ ਕੋਲੋਂ ਇੱਕ ਫ਼ੋਨ ਲਿਆ ਸੀਗਾ ਮੈਨੂੰ ਲੱਗਦਾ ਉਹ ਸੈਮਸੰਗ ਕੰਪਨੀ ਦਾ ਸੀਗਾ ਅਤੇ ਪਹਿਲੀ ਗੱਲ ਤਾਂ ਸਰ ਉਹਦੀ ਜਿਹੜੀ ਡਿਲੀਵਰੀ ਆ ਉਹ ਬਹੁਤ ਲੇਟ ਆਈ ਆ ਅਤੇ ਜਿਹੜਾ ਡਿਲੀਵਰੀ ਵਾਲਾ ਸੀਗਾ ਉਹ ਬਹੁਤ ਜ਼ਿਆਦਾ ਰੂਡਲੀ ਬੀਹੇਵ ਕਰ ਰਿਹਾ ਸੀ ਚਲੋ ਉਹ ਵੀ ਛੱਡੋ ਅਤੇ ਫ਼ੋਨ ਜਦੋਂ ਮੈਂ ਅ ਰੀਸੀਵ ਕੀਤਾ ਪਾਰਸਲ ਆਪਣਾ ਅਤੇ ਫ਼ੋਨ ਦਾ ਜਿਹੜਾ ਡੱਬਾ ਸੀਗਾ ਉਹ ਇੱਦਾਂ ਟੁੱਟਿਆ ਫੁੱਟਿਆ ਪਿਆ ਸੀਗਾ ਮੁੜਿਆ ਪਿਆ ਸੀ ਵੀ ਪਤਾ ਨਹੀਂ ਤੁਸੀਂ ਪੁਰਾਣਾ ਹੀ ਪਾਰਸਲ ਚੱਕ ਕੇ ਕੋਈ ਦੇ ਦਿੱਤਾ ਕਿ ਜਿਹੜਾ ਬਹੁਤ ਟਾਈਮ ਪਹਿਲਾਂ ਦਾ ਆ ਅਤੇ ਜਦੋਂ ਮੈਂ ਉਹਨੂੰ ਡੱਬੇ ਨੂੰ ਖੋਲ੍ਹਿਆ ਤਾਂ ਖੋਲ੍ਹਣ ਤੋਂ ਬਾਅਦ ਕੀ ਦੇਖਿਆ ਕਿ ਉਹ ਜਿਹੜਾ ਕਾਰਡ ਹੈ ਉਹ ਵੀ ਟੁੱਟਿਆ ਪਿਆ ਏ ਜਿਹੜਾ ਫ਼ੋਨ ਆ ਉਹ ਚੰਗੀ ਤਰ੍ਹਾਂ ਚੱਲ ਨਹੀਂ ਰਿਹਾ ਹੈਗਾ ਜਿਹ ਉਹਦੀ ਜਿਹੜੀ ਕੋਈ ਵੀ ਐਪਸ ਹੈ ਉਹ ਚੱਜ ਨਾਲ਼ ਖੁੱਲ੍ਹ ਨਹੀਂ ਰਹੇ ਹੈਗੇ ਆ ਅਤੇ ਸਪੀਕਰ ਦੀ ਆਵਾਜ਼ ਨਹੀਂ ਆ ਰਹੀ ਹੈਗੀ ਕੈਮਰਾ ਜਿਹੜਾ ਪਿੱਛਿਓ ਟੁੱਟਿਆ ਬਲੱਰ ਬਲੱਰ ਸਾਰਾ ਕੁਛ ਦਿਖਾ ਰਿਹਾ ਏ ਅਤੇ ਇੱਥੋਂ ਤੱਕ ਕਿ ਜਿਹੜੀ ਚਾਰਜਿੰਗ ਲੀਡ ਹੈ ਉਹਦੀ ਉਹ ਵੀ ਅੱਧੀ ਟੁੱਟੀ ਹੋਈ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਭੇਜਿਆ ਕੀ ਡਿਲੀਵਰੀ ਕੀ ਕੀਤੀ ਹੈ ਇਹਦੀ ਫ਼ੋਨ ਦੀ ਅਤੇ ਤੁਸੀਂ ਹੁਣ ਇਹਨੂੰ ਜਾਂ ਤਾਂ ਰੀਪਲੇਸ ਕਰੋ ਜਾਂ ਇਹਨੂੰ ਐਕਸਚੇਂਜ ਕਰੋ ਇਹ ਔਪਸ਼ਨ ਹੁਣ ਤੁਹਾਡੇ ਕੋਲ ਆ ਤੁਸੀਂ ਫ ਉਹਨੂੰ ਕੀ ਕਰਨਾ ਆ ਸੱਚੀ ਬਹੁਤ ਜ਼ਿਆਦਾ ਬੇਕਾਰ ਪ੍ਰੋਡਕਟ ਤੁਸੀਂ ਭੇਜਿਆ ਆ ਅਤੇ ਕ੍ਰਿਪਾ ਕਰ ਕੇ ਇਹਨੂੰ ਜਾਂ ਰੀਪਲੇਸ ਕਰੋ ਜਾਂ ਐਕਸਚੇਂਜ ਕਰੋ